ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮਨਾਇਆ ਜਾਣ ਵਾਲੇ ਮੁੱਖ ਸੱਭਿਆਚਾਰ ਜਿਹੜੇ ਤਿਉਹਾਰ ਹਨ ਕਾਫੀ ਹਨ ਜਿੱਦਾਂ ਲੋਹੜੀ ਵਿਸਾਖੀ ਮੁਸਲਮਾਨਾਂ ਦੀ ਈਦ ਜਿਹੜੀ ਹੈਗੀ ਈਦ ਮਨਾਉਂਦੇ ਹਨ ਇੱਥੇ ਕਾਫੀ ਤਿਉਹਾਰ ਜਿਹੜੇ ਵੱਖ ਵੱਖ ਰਿਲੀਜਨ ਦੇ ਲੋਕ ਮਨਾਉਂਦੇ ਹਨ ਅਤੇ ਸਾਡੇ ਜਿਹੜੇ ਦੇਸ਼ ਵਿੱਚ ਤਿਉਹਾਰਾਂ ਦੀ ਕਾਫੀ ਜ਼ਿਆਦਾ ਵਿਸ਼ੇਸ਼ਤਾ ਹੈਗੀ ਹੈ ਜਿੱਦਾਂ ਹੁਣ ਆਪਾਂ ਲੋਹੜੀ ਜਦੋਂ ਮਨਾਉਂਦੇ ਹਨ ਲੋਹੜੀ 'ਤੇ ਸਵੇਰੇ ਲੋਕ ਅੱਜ ਕੱਲ੍ਹ ਦੇ ਲੋਕ ਗੁੱਡੇ ਉਡਾਉਂਦੇ ਹਨ ਅਤੇ ਜਿਹੜੇ ਰਾਤੀ ਫਿਰ ਲੋਹੜੀ ਬਾਲ ਕੇ ਉਹਦੀ ਪੂਜਾ ਕਰਦੇ ਹਨ ਹੁਣ ਜਿੱਦਾਂ ਹੀ ਗੱਲ ਕਰੀ ਦਿਵਾਲੀ ਦੀ ਦਿਵਾਲੀ ਤਿਉਹਾਰ ਵਿੱਚ ਰਾਤ ਨੂੰ ਲੋਕ ਪਟਾਕੇ ਵਜਾਉਂਦੇ ਹਨ ਅਤੇ ਬਾਅਦ 'ਚੋਂ ਮਾਤਾ ਦੀ ਪੂਜਾ ਕਰ ਲੈਂਦੇ ਹਨ ਅਤੇ ਫਿਰ ਉੱਦਾਂ ਹੀ ਆਪਾਂ ਜੇ ਈਦ ਦੀ ਗੱਲ ਕਰੀ ਈਦ ਵਿੱਚ ਜਿਹੜੇ ਮੁਸਲਮਾਨ ਲੋਕ ਆਪਣੀ ਕੋਈ ਚੀਜ਼ ਕਰਦੇ ਹਨ ਉਹ ਮੈਨੂੰ ਇੰਨਾ ਆਈਡੀਆ ਨਹੀਂ ਹੈਗਾ ਉਸ ਚੀਜ਼ ਦਾ ਪਰ ਸਾਡੇ ਜਿਹੜੇ ਇੱਥੇ ਸੱਭਿਆਚਾਰ ਤਿਉਹਾਰ ਹਨ ਕਾਫੀ ਅੱਛੇ ਹਨ ਜਿਹੜੇ ਸੱਭਿਆਚਾਰ ਤਿਉਹਾਰ ਹੈਗੇ ਆ ਹਨ ਉਹ ਹਰ ਦੇਸ਼ ਵਿੱਚ ਹੁੰਦੇ ਹੀ ਹੁੰਦੇ ਹਨ ਉਹ ਹੋਣੇ ਚਾਹੀਦੇ ਹਨ ਅਤੇ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਤਰੀਕੇ ਨਾਲ ਮਨਾਏ ਜਾਂਦੇ ਹਨ ਹੁਣ ਬਾਹਰ ਜਿਸ ਤਰ੍ਹਾਂ ਆਪਾਂ ਦਿੱਲੀ ਬੰਬੇ ਅਲੱਗ ਅਲੱਗ ਥਾਵਾਂ 'ਤੇ ਉਹ ਤਿਉਹਾਰ ਕਾਫੀ ਵੱਡੇ ਲੈਵਲ 'ਤੇ ਮਨਾਏ ਜਿੱਦਾਂ ਗਣੇਸ਼ ਚਤੁਰਥੀ ਹੈ ਹੁਣ ਲੋਕ ਉਸ ਬਾਹਰ ਜਿੱਦਾਂ ਹੁਣ ਮਹਾਰਾਸ਼ਟਰ ਦੇ ਜਿਹੜੇ ਲੋਕ ਹਨ ਉਹ ਉਹਨੂੰ ਮਨਾਉਣ ਲਈ ਕਿੰਨੇ ਵੱਡੇ ਵੱਡੇ ਗਣੇਸ਼ ਜੀ ਦੀ ਮੂਰਤੀਆਂ ਲਿਆਉਂਦੇ ਹਨ ਉਹਨਾਂ ਦੀ ਜ਼ਿਆਦਾਤਰ ਗਿਆਰਾਂ ਦਿਨ ਸੱਤ ਕਈ ਸੱਤ ਦਿਨ ਕਰਦੇ ਕਈ ਗਿਆਰਾਂ ਦਿਨ ਪੂਜਾ ਕਰਦੇ ਹਨ ਅਤੇ ਉਹਨਾਂ ਨੂੰ ਫਿਰ ਉਹ ਵਿਸਰਜਿਤ ਕਰ ਦਿੰਦੇ ਨੇ ਹਨ ਪਾਣੀ ਵਿੱਚ ਅਤੇ ਹੁਣ ਇਸ ਤਰ੍ਹਾਂ ਹੀ ਕਾਫੀ ਜਿਹੜੇ ਤਿਉਹਾਰ ਹੈ ਦੁਨੀਆ ਸਾਡੇ ਦੇਸ਼ਾਂ ਵਿੱਚ ਤਿਉਹਾਰਾਂ ਦੀ ਤਾਂ ਅਹਿਮੀਅਤ ਹੈ ਹਰ ਦੇਸ਼ਾਂ ਵਿੱਚ ਤਿਉਹਾਰਾਂ ਦੀ ਹੀ ਅਹਿਮੀਅਤ ਹੁੰਦੀ ਹਨ ਸਾਡੇ ਦੇਸ਼ਾਂ ਵਿੱਚ ਤਿਉਹਾਰ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਲੋਕ ਇਹਨੂੰ ਵੱਡੇ ਲੈਵਲ 'ਤੇ ਅਪਣਾਉਂਦੇ ਹਨ ਅਤੇ ਮਨਾਉਂਦੇ ਹਨ